ਮੈਂ ਬੱਸ 'ਤੇ ਗਿਆ ਸੀ ਬੱਸ ਦੀ ਡਰਾਈਵਰ ਬੜਾ ਤੇਜ਼ ਗੱਡੀ ਚਲਾਉਂਦਾ ਬੜੀ ਰਫ ਚਲਾਉਂਦਾ ਅਤੇ ਮੈਨੂੰ ਬੱਸ ਇਸ ਕਰਕੇ ਪਸੰਦ ਨਹੀਂ ਆਈ ਸਟੋਰੇਜ ਕੈਰੀਅਰ 'ਚ ਅਸੀਂ ਉੱਪਰ ਸਮਾਨ ਰੱਖੀ ਦਾ ਉਹ ਇੰਨੀ ਤੇਜ਼ ਗੱਡੀ ਚਲਾਉਂਦਾ ਇੱਕ ਦੋ ਵਾਰੀ ਉਹਨੇ ਸਾਡਾ ਸ ਸਮਾਨ ਵੀ ਥੱਲੇ ਸਿੱਟ ਤਾ ਵਿੰਡੋਜ਼ ਬੜੀਆਂ ਉਹਦੀਆਂ ਛੋਟੀਆਂ ਹੁੰਦੀਆਂ ਨੇ ਬਾਹਰ ਸਾਡਾ ਮੂੰਹ ਵੀ ਨਹੀਂ ਜਾਂਦਾ ਹੈਗਾ ਅਤੇ ਵੋਮਿਟ ਆਉਂਦੀ ਅਤੇ ਅਸੀਂ ਵੋਮਿਟ ਵੀ ਨਹੀਂ ਕਰ ਪਾਉਂਦੇ ਹੈਗੇ ਜਦੋਂ ਸੀਟਾਂ 'ਤੇ ਬੈਠੋ ਤਾਂ ਡੀਜ਼ਲ ਇੰਨਾ ਨੱਕ ਨੂੰ ਚੜਦਾ ਕਿ ਬੰਦਾ ਅਗਲੀ ਵਾਰੀ ਸਫ਼ਰ ਕਰਨ ਚ ਵਾਸਤੇ ਬੱਸ ਨੂੰ ਕਦੀ ਲਵੇ ਹੀ ਨਾ ਬੱਸ